ਵੱਖ ਵੱਖ ਮੌਸਮ ਦੇ ਹਿਸਾਬ ਨਾਲ਼ ਜਿਹੜਾ ਫ਼ਲਾਂ ਦੇ ਅਤੇ ਫ਼ੁੱਲਾਂ ਦੇ ਫੁੱਲ ਆਦਿ ਦੇ ਪੌਦੇ ਜਿਹੜੇ ਹੁੰਦੇ ਆ ਉਹਨਾਂ ਨੂੰ ਅਲੱਗ ਅਲੱਗ ਤਰੀਕੇ ਨਾਲ਼ ਰੱਖਣਾ ਪੈਂਦਾ ਵਾ ਕਈ ਵਾਰ ਜਿਵੇਂ ਜ਼ਿਆਦਾ ਠੰਢ ਹੋ ਜਾਂਦੀ ਆ ਅਤੇ ਉਦੋਂ ਉਹਨਾਂ ਨੂੰ ਉਹਨਾਂ ਦੇ ਉੱਪਰ ਕਵਰ ਕਰਨਾ ਪੈਂਦਾ ਪ ਪੌਦਿਆਂ ਨੂੰ ਛੋਟੇ ਬੂਟੇ ਨੂੰ ਨਹੀਂ ਤਾਂ ਖ਼ਰਾਬ ਹੋ ਜਾਂਦੇ ਆ ਪਾਣੀ ਜ਼ਿਆਦਾ ਆ ਜਾਵੇ ਤਾਂ ਪਾਣੀ ਦੇ ਨਾਲ਼ ਵੀ ਬੂਟੇ ਜਿਹੜੇ ਗਲ਼ ਸਕਦੇ ਇਸ ਕਰਕੇ ਪਾਣੀ ਦੀ ਨਿਕਾਸੀ ਜਿਹੜੀ ਹੋਣੀ ਉਹ ਜ਼ਰੂਰੀ ਆ ਮੀਂਹ ਆਦਿ ਜਦੋਂ ਬਰਸਾਤਾਂ ਦਾ ਮੌਸਮ ਹੁੰਦਾ ਵਾ ਅਤੇ ਉਦੋਂ ਪਾਣੀ ਖੜ੍ਹਾ ਨਹੀਂ ਰਹਿਣ ਦੇਣਾ ਚਾਹੀਦਾ ਪਾਣੀ ਨੂੰ ਕੱਢਣਾ ਪੈਂਦਾ ਬਾਹਰ ਜ਼ਮੀਨ ਦੇ ਵਿੱਚੋਂ ਜਦੋਂ ਜ਼ਿਆਦਾ ਗਰਮੀ ਹੁੰਦੀ ਆ ਉਦੋਂ ਵੀ ਗਰਮੀ ਦੇ ਨਾਲ਼ ਪੌਦੇ ਸੁੱਕਣਾ ਸ਼ੁਰੂ ਕਰ ਦਿੰਦੇ ਆ ਅਤੇ ਉਹਨਾਂ ਵਾਸਤੇ ਇੱਕ ਤਾਂ ਸਾਨੂੰ ਵਾਰ ਵਾਰ ਪਾਣੀ ਦਿੰਦੇ ਰਹਿਣਾ ਪੈਂ ਚਾਹੀਦਾ ਉਹਨੂੰ ਦੂਜਾ ਉਹਨੂੰ ਉਹਦੇ ਉੱਪਰ ਛਾਂ ਕਰਨੀ ਚਾਹੀਦੀ ਹੈ ਛੋਰਾ ਕਰਨਾ ਚਾਹੀਦਾ ਵਾ ਜਿਹੜਾ ਕਿ ਜ਼ਿਆਦਾ ਤੇਜ਼ ਧੁੱਪ ਨਾਲ਼ ਵੀ ਬੂਟੇ ਨਾ ਸੁੱਕਣ ਜਦੋਂ ਕੋਰਾ ਵਗੈਰਾ ਦਾ ਹੁੰਦਾ ਠੰਢ ਜ਼ਿਆਦਾ ਹੁੰਦੀ ਆ ਉਦੋਂ ਵੀ ਉਹਨੂੰ ਜਿਹੜਾ ਕਵਰ ਕਰਨਾ ਪੈਂਦਾ ਵਾ ਉੱਧਰਲੀ ਸਾਈਡ ਤੋਂ ਜਿੱਧਰੋਂ ਕੋਰਾ ਪੈਂਦਾ ਜਾਂ ਬਰਸਾਤ ਦੇ ਵਿੱਚ ਜ਼ਿਆਦਾਤਰ ਸੁੰਡੀ ਪੈਂਦੀ ਆ ਅਤੇ ਅਲੱਗ ਅਲੱਗ ਮੌਸਮ ਨਾਲ਼ ਸੁੰਡੀ ਬਣਦੀ ਆ ਅਤੇ ਸੁੰਡੀ ਦੇ ਉੱਤੋਂ ਸਪਰੇਆਂ ਕਰਨੀਆਂ ਪੈਂਦੀਆਂ ਵਾ ਦਵਾਈਆਂ ਛਿੜਕਣੀਆਂ ਪੈਂਦੀਆਂ